ਸਤਿ ਸ਼੍ਰੀ ਅਕਾਲ ਮੈਂ ਪਰਮਜੀਤ ਗੁਰਦਾਸਪੁਰ ਤੋਂ ਸਾਡੇ ਦੇਸ਼ ਵਿੱਚ ਵੱਖ ਵੱਖ ਤਰ੍ਹਾਂ ਦੇ ਜਾਨਵਰ ਹਨ ਕੁਝ ਜਾਨਵਰ ਅਸੀਂ ਘਰਾਂ ਵਿੱਚ ਪਾਲ ਦੇ ਕੇ ਉਹਨਾਂ ਤੋਂ ਆਮਦਨ ਪ੍ਰਾਪਤ ਕਰਦੇ ਹਾਂ ਜਿਵੇਂ ਕਿ ਭੇਡ ਬੱਕਰੀਆਂ ਪਾਲਦੇ ਹਾਂ ਉਹਨਾਂ ਤੋਂ ਅਸੀਂ ਦੁੱਧ ਪ੍ਰਾਪਤ ਕਰਦੇ ਹਾਂ ਗਾਈਆਂ ਮੱਝਾਂ ਤੋਂ ਵੀ ਅਸੀਂ ਦੁੱਧ ਪ੍ਰਾਪਤ ਕਰਦੇ ਹਾਂ ਤਾਂ ਫੈਕਟਰੀਆਂ ਨੂੰ ਭੇਜਦੇ ਹਾਂ ਜਿਹਨਾਂ ਨੂੰ ਭੇਡਾਂ ਨੂੰ ਭੇਡਾਂ ਦੀ ਨੂੰ ਸਾਫ਼ ਕਰਕੇ ਭੇਡਾਂ ਦੀਆਂ ਜੱਤਾਂ ਨੂੰ ਸਾਫ਼ ਕਰਕੇ ਉਹਨਾਂ ਦੀ ਉੱਨ ਬਣਦੀ ਹੈ ਅਤੇ ਲੋਕਾਂ ਦੀ ਆਮਦਨ ਦਾ ਸ ਸਾਧਨ ਹੈ ਅਤੇ ਲੋਕ ਗਊਆਂ ਵੀ ਪਾਲਦੇ ਹਨ ਜਿਹਨਾਂ ਦਾ ਦੁੱਧ ਸ਼ੁੱਧ ਅਤੇ ਉਹ ਪੋਸ਼ਟਿਕ ਹੋਣ ਕਰਕੇ ਲੋਕ ਜ਼ਿਆਦਾ ਖਰੀਦਦੇ ਹਨ ਅਤੇ ਮੁਰਗੀ ਪਾਲਣ ਦਾ ਧੰਦਾ ਵੀ ਕਾਫੀ ਪ੍ਰਚਲਿਤ ਹੈ ਮੁਰਗੀ ਪਾਲਣ ਕਰਕੇ ਉਹਨਾਂ ਦਾ ਆ ਆਂਡਿਆਂ ਦਾ ਆਂਡਿਆਂ ਤੋਂ ਲੋਕ ਪੈਸਾ ਕਮਾਉਂਦੇ ਹਨ ਲੋਕਾਂ ਨੇ ਮੁਰਗੀਖਾਨੇ ਵੀ ਖੋਲ੍ਹੇ ਹਨ ਹੋਏ ਅਤੇ ਘਰ ਵਿੱਚ ਵੀ ਪਾਲਦੇ ਹਨ ਜੀ ਹਾਂ ਇਹ ਬੜਾ ਬੜਾ ਵੱਡਾ ਆਮਦਨ ਦਾ ਸਰੋਤ ਹੈ ਕੁਝ ਲੋਕਾਂ ਦੀ ਰੋਜੀ ਰੋਟੀ ਇਸ ਤੋਂ ਹੀ ਚਲਦੀ ਹੈ ਇਸ ਕਰਕੇ ਇਸ ਕਰਕੇ ਸਾਰੇ ਜਾਨਵਰ ਰੱਖ ਜਾਨਵਰ ਰੱਖ ਸਕਦੇ ਹਾਂ ਅਤੇ ਅਸੀਂ ਆਪ ਨੂੰ ਜਾਨਵਰਾਂ ਨੂੰ ਇੱਕ ਧੰਦੇ ਦੇ ਤੌਰ 'ਤੇ ਵੀ ਕਵਰ ਕਰ ਤਿਆਰ ਕਰ ਕੇ ਰੱਖਦੇ ਹਾਂ ਧੰਨਵਾਦ ਧੰਨਵਾਦ